ਬੱਚਿਆਂ ਦੇ ਵਿਕਾਸ ਲਈ ਅੱਜ ਕੱਲ੍ਹ ਬਹੁਤ ਕੁਛ ਹੈਗਾ ਪਹਿਲੀ ਗੱਲ ਤਾਂ ਬੱਚੇ ਅੱਜ ਕੱਲ੍ਹ ਪਲੇ ਵੇ ਸਕੂਲ 'ਚ ਜਾਂਦੇ ਨੇ ਉੱਥੇ ਬਹੁਤ ਕੁਛ ਸਿਖਾਉਂਦੀਆਂ ਨੇ ਟੀਚਰਾਂ ਬਹੁਤ ਵਧੀਆ ਨੇ ਫਿਰ ਉਸ ਤੋਂ ਬਾਅਦ ਘਰ ਆ ਕੇ ਬੱਚੇ ਮੋਬਾਇਲ ਲੈਂਦੇ ਨੇ ਮੋਬਾਇਲ ਵਿੱਚੋਂ ਨੋਲੇਜ ਆ ਜਾਂਦੀ ਹੈ ਚਲੋ ਚਾਹੇ ਗੇਮ ਹੀ ਖੇਡਦੇ ਨੇ ਆਉਂਦੀ ਹੈ ਨੋਲੇਜ ਉਸ ਤੋਂ ਬਾਅਦ ਬੱਚੇ ਜਦੋਂ ਵੱਡੇ ਸਕੂਲ 'ਚ ਜਾਂਦੇ ਨੇ ਉੱਥੇ ਬੱਚਿਆਂ ਨੂੰ ਬਹੁਤ ਕੁਛ ਐਕਟੀਵਿਟੀ ਕਰਵਾਉਂਦੇ ਨੇ ਮੈਡਮਾਂ ਬਹੁਤ ਕੁਛ ਸਿਖਾਉਂਦੀਆਂ ਨੇ ਬਹੁਤ ਵਧੀਆ ਚਲਦਾ ਕੰਮ ਫਿਰ ਬੱਚੇ ਘਰ ਆ ਕੇ ਵੀ ਅੱਜ ਕੱਲ੍ਹ ਪੇਰੈਂਟਸ ਜਿਹੜੇ ਹੈਗੇ ਨੇ ਬੱਚਿਆਂ ਨੂੰ ਬਹੁਤ ਨੋਲੇਜ ਦਿੰਦੇ ਨੇ ਬੱਚਿਆਂ ਨੂੰ ਬਹੁਤ ਅੱਗੇ ਲਿਜਾਉਣ ਦੀ ਕੋਸ਼ਿਸ਼ ਹੈਗੀ ਆ ਅੱਜ ਕੱਲ੍ਹ ਕੰਪਟੀਸ਼ਨ ਬਹੁਤ ਜ਼ਿਆਦਾ ਹੈਗਾ ਇਸ ਕਰਕੇ ਅਖਬਾਰਾਂ ਵੀ ਪੜ੍ਹਦੇ ਨੇ ਬੱਚੇ ਸਕੂਲਾਂ ਵਿੱਚ ਵੀ ਪ੍ਰੇਰਿਤ ਕਰਦੇ ਹੈਗੇ ਨੇ ਵੀ ਬੱਚੇ ਜਾ ਘਰ ਜਾ ਕੇ ਅਖਬਾਰ ਪੜ੍ਹਨ ਮੋਬਾਈਲ ਨਾ ਦੇਖਣ ਵੱਧ ਤੋਂ ਵੱਧ ਐਕਟੀਵਿਟੀ ਘਰ ਪੇਰੈਂਟਸ ਕਰਵਾਉਣ ਅਤੇ ਬਹੁਤ ਵਧੀਆ ਨੋਲੇਜ ਮਿਲਦੀ ਹੈ ਬੱਚਿਆਂ ਨੂੰ